ਭਾਰਤ ਦੀ ਸਰਕਾਰੀ ਭਾਸ਼ਾਵਾਂ ਹਿੰਦੀ ਅਤੇ ਅੰਗਰੇਜ਼ੀ ਹਨ ਵੈਸੇ ਤਾਂ ਭਾਰਤ ਵਿੱਚ ਸੱਤ ਸੌ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਜਿਸ ਤਰ੍ਹਾਂ ਕਿ ਆਸਾਮੀ ਬੰਗਾਲੀ ਡੋਗਰੀ ਹਿੰਦੀ ਗੁਜਰਾਤੀ ਤਾਮਿਲ ਕਸ਼ਮੀਰੀ ਕੰਨੜ ਤੇਲਗੂ ਸਿੰਧੀ ਸੰਤਾਲੀ ਮਨੀਪੁਰ ਮੈਥਲੀ ਨੇਪਾਲੀ ਮਲਿਆਲਮ ਉੜੀਆ ਮਰਾਠੀ ਪੰਜਾਬੀ ਭਾਰਤ ਵਿੱਚ ਅਠਾਈ ਰਾਜਾਂ ਵਿੱਚ ਵੰਡਿਆ ਹੈ ਅੱਠ ਕੇਂਦਰਾਂ ਤੋਂ ਸ਼ਾਸਿਤ ਹੁੰਦੇ ਹਨ ਹਰ ਰਾਜ ਵਿੱਚ ਵੱਖ ਵੱਖ ਭਾਸ਼ਾ ਬੋਲੀ ਜਾਂਦੀ ਹੈ ਹਰ ਭਾਸ਼ ਰਾਜ ਵਿੱਚ ਆਪਣੀ ਵੱਖਰੀ ਭਾਸ਼ਾ ਹੈ ਹਿੰਦੀ ਰਾਸ਼ਟਰ ਭਾਸ਼ਾ ਹੋਣ ਕਰਕੇ ਸਾਰੇ ਰਾਜਾਂ ਵਿੱਚ ਬੋਲੀ ਹੈ ਬੋਲੀ ਜਾਂਦੀ ਹੈ ਅਤੇ ਸਮਝੀ ਜਾਂਦੀ ਹੈ ਇਸ ਕਰਕੇ ਅਨੇਕਤਾ ਵਿੱਚ ਏਕਤਾ ਦੀ ਦਾ ਅਹਿਸਾਸ ਹੁੰਦਾ ਹੈ ਸਾਰੀਆਂ ਬੋਲੀਆਂ ਬਹੁਤ ਮਿੱਠੀਆਂ ਹਨ ਅਤੇ ਇਹਨਾਂ ਨੂੰ ਇੱਕ ਦੂਜੇ ਤੋਂ ਸਿੱਖ ਕੇ ਬੋਲਦੇ ਹਨ ਅਤੇ ਜਿਸ ਤਰ੍ਹਾਂ ਭਾਰਤ ਵਿੱਚ ਹਿੰਦੂ ਸਿੱਖ ਈਸਾਈ ਮੁਸਲਮਾਨ ਬੰਗਾਲੀ ਜਿੰਨੇ ਵੀ ਲੋਕ ਰਹਿੰਦੇ ਹਨ ਉਹ ਪੰਜਾਬ ਦੀ ਭਾਸ਼ਾ ਸਿੱਖਦੇ ਹਨ ਅਤੇ ਉਹਨੂੰ ਬੜੇ ਪਿਆਰ ਨਾਲ ਬੋਲਦੇ ਹਨ